ਹਾਂ ਮੈਂ ਸਵੈਟਰ ਬਣਾਉਣ ਦੀ ਸਿਲਾਈ ਲਈ ਹੈ ਮੈਂ ਇਹ ਸਿਲਾਈ ਆਪਣੀ ਦਾਦੀ ਜੀ ਤੋਂ ਲਈ ਹੈ ਅਤੇ ਮੇਰੇ ਮੰਮਾ ਨੇ ਵੀ ਮੈਨੂੰ ਉਸ ਸਵੈਟਰ ਬਣਾਉਣ ਦੀ ਸਿਖਲਾਈ ਦਿੱਤੀ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੈਂ ਵੇਖਦੀ ਹੁੰਦੀ ਸੀ ਕਿ ਮੇਰੀ ਦਾਦੀ ਜੀ ਹੱਥ ਵਿੱਚ ਸਲਾਈਆਂ ਅਤੇ ਇੱਕ ਉੱਨ ਦਾ ਗੋਲਾ ਫੜ ਕੇ ਕੋਈ ਨਾ ਕੋਈ ਡਿਜ਼ਾਇਨ ਬਣਾ ਰਹੇ ਹੁੰਦੇ ਸੀ ਜਦੋਂ ਮੈਂ ਵੱਡੀ ਹੋਈ ਤਾਂ ਮੇਰਾ ਵੀ ਮਨ ਕੀਤਾ ਕਿਉਂ ਨਾ ਮੈਂ ਵੀ ਸਵੈਟਰ ਬਣਾਉਣਾ ਸਿੱਖਾਂ ਪਰ ਇਹ ਨੂੰ ਸਿੱਖਣਾ ਉਹ ਬਹੁਤ ਸੌਖਾ ਨਹੀਂ ਸੀ ਮੈਨੂੰ ਇਹ ਸਿੱਖਣ ਵਿੱਚ ਬੜਾ ਟਾਈਮ ਲੱਗਾ ਮੇਰੀ ਮਾਤਾ ਜੀ ਮੈਨੂੰ ਹਰ ਵੇਲੇ ਕੋਈ ਨਾ ਕੋਈ ਨਵਾਂ ਤੋਂ ਨਵਾਂ ਉਨਤੀ ਬਣਾ ਕੇ ਦਿੰਦੇ ਸੀ ਫਿਰ ਮੈਂ ਉਹਨਾਂ ਦੀ ਬਣਾਈ ਹੋਈ ਉਨਤੀ ਨੂੰ ਵੇਖ ਕੇ ਇੱਕ ਡਿਜ਼ਾਇਨ ਬਣਾਉਂਦੀ ਸੀ ਮੇਰੇ ਕੋਲ ਬੜੀ ਵਾਰ ਇਹ ਡਿਜ਼ਾਇਨ ਖਰਾਬ ਹੋਏ ਪਰ ਹੌਲੀ ਹੌਲੀ ਇੱਕ ਮੈਂ ਇਹਨਾਂ ਨੂੰ ਬਣਾਉਂਦੀ ਰਹੀ ਅਤੇ ਇਹ ਹੌਲੀ ਹੌਲੀ ਇਸ ਨੂੰ ਸਿੱਖ ਗਈ ਮੈਂ ਇੱਕ ਆਪਣੇ ਲਈ ਦੋ ਸਵੈਟਰ ਬਣਾਏ ਜੋ ਕਿ ਬਹੁਤ ਹੀ ਸੋਹਣੀ ਆ ਅਤੇ ਅਤੇ ਜਦੋਂ ਮੈਂ ਪਾਏ ਅਤੇ ਲੋਕਾਂ ਨੇ ਮੈਨੂੰ ਬਹੁਤ ਹੀ ਸਰਾਇਆ ਅਤੇ ਮੇਰੀ ਮਮਾ ਜੀ ਨੇ ਵੀ ਕਿਹਾ ਕਿ ਤੁਸੀਂ ਇਸ ਨੂੰ ਹੋਰ ਵੀ ਵਧੀਆ ਇਮਪਰੂਵ ਕਰ ਸਕਦੀਆਂ ਅਤੇ ਹੋਰ ਵੀ ਸਵੈਟਰ ਬਣਾ ਸਕਦੀ ਆ ਆਪਣੇ ਵਾਸਤੇ ਇਸ ਦੀ ਸਿਖਲਾਈ ਵੀ